ਹਾਂ ਮੇਰੇ ਭੈਣ ਅਤੇ ਭਰਾ ਹਨ ਮੈਂ ਉਹਨਾਂ ਤੋਂ ਸਮਾਨ ਜਾਂ ਵੱਖਰੇ ਹੋਣ ਦਾ ਜਿਹੜਾ ਮੈਂ ਮੇਰਾ ਅਨੁਭਵ ਹੈ ਉਹ ਇਹ ਹੈ ਵੀ ਇਨਸਾਨ ਤਾਂ ਦੇਖੋ ਦੇਖਣ ਵਾਸਤੇ ਸਾਰੇ ਇੱਕੋ ਜਿਹੇ ਲੱਗਦੇ ਨੇ ਪਰੰਤੂ ਜਿਹੜਾ ਮੇਰਾ ਨੇਚਰ ਉਹ ਧਾਰਮਿਕ ਹੈ ਅਤੇ ਮੇਰੇ ਭੈਣ ਭਰਾ ਦਾ ਜਿਹੜਾ ਨੇਚਰ ਹੈ ਉਹ ਨਹੀਂ ਧਾਰਮਿਕ ਨਹੀਂ ਹੈ ਬਸ ਇਹੋ ਬਹੁਤ ਵੱਡਾ ਫਰਕ ਹੈ